ਅੱਜ ਕੱਲ੍ਹ ਇੰਟਰਨੈਟ ਦੇ ਸਮੇਂ ਵਿੱਚ ਇੰਟਰਨੈਟ ਬੈਂਕਿੰਗ ਹੀ ਵਧੇਰੇ ਤਰਜੀਹੀ ਹੈ ਜੋ ਕਿ ਸਾਡੇ ਸਮੇਂ ਨੂੰ ਬਚਾਉਂਦੀ ਹੈ ਅਤੇ ਮੂਲਵਾਨ ਸਮਾਂ ਸਾਡਾ ਹੋਰ ਕਿਸੇ ਲੇਖੇ ਲੱਗ ਜਾਂਦਾ ਹੈ ਇੰਟਰਨੈਟ ਬੈਂਕਿੰਗ ਵਿੱਚ ਸਾਨੂੰ ਕਈ ਕ ਤਰ੍ਹਾਂ ਦੀਆਂ ਸਕੀਮਾਂ ਦੀ ਅਤੇ ਵੱਖ ਵੱਖ ਤਰੀਕਿਆਂ ਦੀ ਵੀ ਸਮਝ ਲੱਗ ਜਾਂਦੀ ਹੈ ਇਸ ਲਈ ਇੰਟਰਨਰ ਬੈਂਕਿੰਗ ਵਧੇਰੇ ਤਰਜੀਹੀ ਹੈ